ਅੱਜ ਕੱਲ ਹਰ ਬੰਦਾ ਬਿਮਾਰ ਰਹਿੰਦਾ ਜੀ ਹਸਪਤਾਲਾਂ ਦੇ ਗੇੜੇ ਲੱਗਦੇ ਰਹਿੰਦੇ ਸਾਡੇ ਇੱਧਰ ਦੇ ਹਸਪਤਾਲਾਂ 'ਚ ਬਾਹਲੀਆਂ ਲੰਬੀਆਂ ਲੰਬੀਆਂ ਲਾਈਨਾਂ ਬਾਹਲੀ ਭੀੜ ਹੁੰਦੀ ਬਹੁਤ ਸਮਾਂ ਖੜ੍ਹਨਾ ਪੈਂਦਾ ਉੱਥੇ ਲੰਬੀਆਂ ਲੰਬੀਆਂ ਲਾਈਨਾਂ ਹੁੰਦੀਆਂ ਮੈਂ ਤਾਂ ਖੁਦ ਬਿਮਾਰ ਰਹਿੰਦੀ ਹੈ ਜੀ ਮੈਨੂੰ ਥੋੜ੍ਹੀ ਸਾਹ ਦੀ ਵੀ ਦਿੱਕਤ ਹੈ ਅਤੇ ਮੇਰੇ ਦੰਦਾਂ ਵਿੱਚ ਵੀ ਦਿੱਕਤ ਹੈ ਜਦ ਮੈਂ ਹਸਪਤਾਲ ਜਾਂਦੀ ਹਾਂ ਤਾਂ ਮੈਨੂੰ ਕਿੰਨਾਂ ਕਿੰਨਾਂ ਸਮਾਂ ਖੜ੍ਹਨਾ ਪੈਂਦਾ ਉੱਥੇ